ਭਾਰਤ ਸਰਕਾਰ ਨੇ ਆਪਣੀ ਨਾਗਰਿਕਾਂ ਦੇ ਕਲਿਆਣ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਇਹ ਸਕੀਮਾਂ ਨਾ ਵੱਖ ਵੱਖ ਤਰ੍ਹਾਂ ਖੇਤਰਾਂ 'ਚ ਸਿਹਤ ਸਿੱਖਿਆ ਰੁਜ਼ਗਾਰ ਖੇਤੀਬਾੜੀ ਅਤੇ ਸਮਾਜਿਕ ਸੁਰੱਖਿਆ ਨੂੰ ਕਵਰ ਕਰਦੇ ਹਨ ਅਸੀਂ ਕੁਝ ਪ੍ਰਸਿੱਧ ਸਕੀਮਾਂ ਹਨ ਜਿਵੇਂ ਆਯੁਸ਼ਮਾਨ ਭਾਰਤ ਯੋਜਨਾ ਇਹ ਯੋਜਨਾ ਗਰੀਬ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਸਿਹਤ ਬੀਮਾ ਪ੍ਰਦਾਨ ਕਰਦੀ ਹੈ ਜਨਾਨੀ ਸੁਰੱਖਿਆ ਯੋਜਨਾ ਇਹ ਯੋਜਨਾ ਗਰਭਵਤੀ ਔਰਤਾਂ ਨੂੰ ਮੁਫਤ ਸਿਹਤ ਜਾਂਚ ਅਤੇ ਜਨੇਪੇ ਲਈ ਜ਼ਰੂਰੀ ਸਹੂਲਤਾਂ ਪ੍ਰਾਪਤ ਕਰਦੀਆਂ ਰਾਸ਼ਟਰੀ ਬਾਲ ਸਹਿਤ ਰਾਜਕ੍ਰਮ ਇਹ ਯੋ ਯੋਜਨਾ ਨਾ ਬੱਚਿਆਂ ਨੂੰ ਮੁਫਤ ਸਹਿਤ ਜਾਂਚ ਇਲਾਜ ਪ੍ਰਦਾਨ ਕਰਦੀ ਹੈ ਸਿੱਖਿਆ ਸਰਵ ਸਿੱਖਿਆ ਅਭਿਮਾਨ ਅਭਿਆਨ ਇਹ ਯੋਜਨਾ ਛੇ ਤੋਂ ਚੌਦ੍ਹਾਂ ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਮੁਫਤ ਯੋਜਨਾ ਲਾਜ਼ਮੀ ਸਿੱਖਿਆ ਪ੍ਰਦਾਨ ਕਰਦੀ ਹੈ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਮਾਨ ਇਹ ਯੋਜਨਾ ਚੌਦ੍ਹਾਂ ਤੋਂ ਅਠਾਰ੍ਹਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਲਾਜ਼ਮੀ ਸਿੱਖਿਆ ਪ੍ਰਦਾਨ ਕਰਦੀ ਹੈ ਬੇਟੀ ਬਚਾਓ ਅਤੇ ਪੜਾਓ ਇਹ ਯੋਜਨਾ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ ਰੁਜ਼ਗਾਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਇਹ ਯੋਜਨਾ ਖੇਤਰਾਂ ਅਤੇ ਹਰੇਕ ਪਰਿਵਾਰਾਂ ਨੂੰ ਸ਼ਾਨ ਵਿੱਚ ਸੌ ਦਿਨਾਂ ਦਾ ਰੁਜ਼ਗਾਰ ਪ੍ਰਦਾਨ ਕਰਦੀ ਹੈ ਪ੍ਰਧਾਨ ਮੰਤਰੀ ਯੋਜ ਕੌਸ਼ਲ ਯੋਜਨਾ ਇਹ ਯੋਜਨਾ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ ਮੁਦਰਾ ਯੋਜਨਾ ਇਹ ਯੋਜਨਾ ਛੋਟੇ ਕਾਰੋਬਾਰ ਨੂੰ ਕਰਜ਼ੇ ਤੋਂ ਪ੍ਰਦਾਨ ਕਰਦੀ ਹੈ ਖੇਤੀਬਾੜੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਇਹ ਯੋਜਨਾ ਕਿਸਾਨਾਂ ਨੂੰ ਸੱਠ ਹਜ਼ਾਰ ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਫਸਲ ਬੀਮਾ ਯੋਜਨਾ ਇਹ ਯੋਜਨਾ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ ਰਾਸ਼ਟਰੀ ਖੇਤੀਬਾੜੀ ਬਾਜ਼ਾਰ ਇਹ ਯੋਜਨਾ ਕਿਸਾਨਾਂ ਨੂੰ ਆਪਣੀ ਫਸਲ ਆਨਲਾਈਨ ਵੇਚਣ ਦੀ ਸਹੂਲਤ ਪ੍ਰਦਾਨ ਕਰਦੀ ਹੈ ਸਮਾਜਿਕ ਸੁਰੱਖਿਆ ਪ੍ਰਧਾਨ ਮੰਤਰੀ ਜਨ ਯੋਜਨਾ ਇਹ ਸਾਰੇ ਯੋਜਨਾ ਨਾਗਰਿਕਾਂ ਨੂੰ ਬੈਂਕ ਖਾਤੇ ਪ੍ਰਦਾਨ ਕਰਦੀ ਹੈ ਪ੍ਰਧਾਨ ਮੰਤਰੀ ਉੱਜਵਲਤਾ ਯੋਜਨਾ ਇਹ ਯੋਜਨਾ ਗਰੀਬ ਪਰਿਵਾਰਾਂ ਨੂੰ ਮੁਫਤ ਐਲਪੀਜੀ ਇੱਕ ਕਨੈਕਸ਼ਨ ਪ੍ਰਦਾਨ ਕਰਦੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਹ ਯੋਜਨਾ ਗਰੀਬ ਪਰਿਵਾਰ ਨੂੰ ਘਰ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਹ ਸਕੀਮਾਂ ਦਾ ਲਾਭ ਲੈਣ ਲਈ ਤੁਹਾਨੂੰ ਆਪਣੀ ਯੋਗਤਾ ਅਤੇ ਲੋੜ ਅਨੁਸਾਰ ਅਰਜ਼ੀ ਦੇਣੀ ਪਵੇਗੀ ਤੁਸੀਂ ਸਰਕਾਰ ਦੀ ਵੈਬਸਾਈਟ ਜਾਂ ਆਪਣੇ ਨੇੜੇ ਸਰਕਾਰੀ ਦਫਤਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਲਈ ਬਹੁਤ ਲਾਭ ਮਿਲੇਗਾ ਜੇਕਰ ਤੁਸੀਂ ਹੋਰ ਇਸਦਾ ਸਾਰਾ ਕੁਝ ਇੰਤਜ਼ਾਮ ਸਰਕਾਰ ਵੱਲੋਂ ਕਰਵਾਇਆ ਜਾਂਦਾ ਹੈ